ਇੱਕ ਸੰਗੀਤ ਉੱਤੇ ਅਧਾਰਤ ਕਸਰਤ ਹੈ ਪੰਜਾਬੀ ਸੱਭਿਅਤਾ ਦੀ ਦੇਣ ਜ਼ਰੂਰ ਹੈ ਇਸ ਪ੍ਰਣਾਲੀ ਵਿੱਚ ਤਨ ਮਨ ਤੰਦਰੁਸਤ ਅਤੇ ਚੁਸਤ ਰਹਿੰਦਾ ਹੈ ਸਰੀਰ ਨੂੰ ਤੰਦਰੁਸਤ ਰੱਖਣ ਲਈ ਤਣਾਅ ਨੂੰ ਦੂਰ ਕਰਨ ਲਈ ਅੱਜ ਦਾ ਨੌਜਵਾਨ ਵਰਗ ਐਰੋਬਿਕਸ ਨੂੰ ਅਪਣਾਉਂਦਾ ਹੈ ਸੰਗੀਤਮਈ ਵਾਤਾਵਰਨ ਵਿੱਚ ਐਰੋਮਿਕਸ ਦਾ ਆਨੰਦ ਹੋਰ ਵੀ ਵੱਧ ਜਾਂਦਾ ਹੈ ਸੰਗੀਤਮਈ ਐਰੋਬਿਕਸ ਤਣਾਅ ਨੂੰ ਦੂਰ ਦੂਰ ਕਰਦੀ ਹੈ ਅਤੇ ਬਿਮਾਰੀਆਂ ਨੂੰ ਲੜਨ ਦੀ ਸਮਰੱਥਾ ਪ੍ਰਦਾਨ ਕਰਦੀ ਹੈ ਮੋਟਾਪਾ ਦੂਰ ਕਰਕੇ ਸਰੀਰ ਨੂੰ ਤੰਦਰੁਸਤ ਵੀ ਬਣਾਉਂਦੀ ਹੈ ਬਹੁਤ ਬਹੁਤ ਸਾਰੇ ਦੇਸ਼ਾਂ ਤੋਂ ਬਾਅਦ ਐਰੋਬਿਕਸ ਕਸਰਤ ਨੇ ਹੁਣ ਭਾਰਤ ਵਿੱਚ ਆਪਣੀ ਜੜ੍ਹਾਂ ਬਣਾ ਲਈਆਂ ਹਨ ਉੱਨੀ ਸੌ ਅੱਸੀ ਦੇ ਬਾਅਦ ਭਾਰਤ ਦੇ ਮਹਾਂਨਗਰਾਂ ਮਹਾਂਨਗਰਾਂ ਨਾਲ ਨਾਲ ਲਗਭਗ ਸਾਰੇ ਹੀ ਸ਼ਹਿਰਾਂ ਵਿੱਚ ਐਰੋਬਿਕਸ ਅਤੇ ਜਿੰਮ ਕੇਂਦਰ ਖੁੱਲ੍ਹਣ ਲੱਗੇ ਸਾਨੂੰ ਇਹ ਨਹੀਂ ਇਹ ਨਹੀਂ ਭੁੱਲਣਾ ਚਾਹੀਦਾ ਕਿ ਐਰੋਬਿਕਸ ਨਾਲ ਨਾਲ ਯੋਗ ਦਾ ਮਹੱਤਵ ਹੋਰ ਵੀ ਵੱਧ ਹੈ ਅੱ ਅੱਜ ਕੇਂਦਰਾਂ ਵਿੱਚ ਜਿੰਮ ਦੀ ਸਿਖਲਾਈ ਦਿੱਤੀ ਜਾਂਦੀ ਹੈ ਮਸ਼ੀਨ ਨਾਲ ਸਰੀਰ ਦੇ ਨਾਲ ਸਰੀਰ ਦੇ ਨਾਲ ਨਾਲ ਵਿਅਕਤੀ ਦਾ ਚਿਹਰਾ ਵੀ ਆਕਰਸ਼ਕ ਬਣਨ ਲੱਗਦਾ ਹੈ ਗਰੁੱਪ ਦੇ ਨਾਲ ਡੇਢ ਦੋ ਘੰਟੇ ਲਗਾਤਾਰ ਕਸਰਤ ਕਰਨ ਨਾਲ ਵੀ ਥਕਾਵਟ ਨਹੀਂ ਵੀ ਮਹਿਸੂਸ ਹੁੰਦੀ ਇਸ ਦਾ ਕਾਰਨ ਸੰਗੀਤ ਹੀ ਹੈ ਧੰਨਵਾਦ ਜੀ